ਛਪੰਜਾ ਤਿੰਨ ਸੌ ਛਪੰਜਾ ਪੰਜ ਸੌ ਅਠਤਾਲੀ ਦੋ ਹਜ਼ਾਰ ਅਠਤਾਲੀ ਬਾਰ੍ਹਾਂ ਸੌ ਪੰਜਾਹ ਸੱਤ ਸੌ ਪਚਵੰਜਾ ਛੇ ਸੌ ਛਿਆਹਠ ਅੱਠ ਸੌ ਛਿਹੱਤਰ ਨੌ ਸੌ ਪਚਾਸੀ ਗਿਆਰ੍ਹਾਂ ਸੌ ਬਾਰ੍ਹਾਂ